ਵੈਸੇ ਤਾਂ ਪੰਜਾਬ ਵਿੱਚ ਬਹੁਤ ਸਾਰੀਆਂ ਹੈ ਹੈ ਇੱਦਾਂ ਦੀਆਂ ਜਗ੍ਹਾ ਨੇ ਜਿੱਥੇ ਅਸੀਂ ਘੁੰਮ ਸਕਦੇ ਹਾਂ ਅਤੇ ਆਪਾਂ ਸਾਡੀ ਜਿਹੜੀ ਵਿਰਾਸਤ ਆ ਉਹਨੂੰ ਦੇਖ ਸਕਦੇ ਅ ਜਿਵੇਂ ਕਿ ਸਾਡੇ ਪੰਜਾਬ ਦੇ ਵਿੱਚ ਹੈਗਾ ਆ ਵਿਰਾਸਤ ਏ ਖਾਲਸਾ ਜਿਹਦੇ ਵਿੱਚ ਸਾਨੂੰ ਦਿਖਾਇਆ ਗਿਆ ਹੈ ਕਿ ਕਿੱਦਾਂ ਸਾਡੇ ਜਿਹੜੇ ਗੁਰੂ ਸੀਗੇ ਉਹਨਾਂ ਨੇ ਕੀ ਕੀ ਸਾਡੇ ਲਈ ਕੀਤਾ ਅਤੇ ਕਿੱਦਾਂ ਕਿੱਦਾਂ ਕੀਤਾ ਹੈਗਾ ਆ ਅਤੇ ਉਸੇ ਤਰੀਕੇ ਨਾਲ ਜੇ ਆਪਾਂ ਹੋਰ ਘੁੰਮਣ ਦੀ ਜਗ੍ਹਾ ਦੇਖੀਏ ਤਾਂ ਇੱਧਰ ਚੰਡੀਗੜ੍ਹ ਹੋ ਗਿਆ ਸੁਖਨਾ ਲੇਕ ਹੋ ਗਿਆ ਅਤੇ ਰੌਕ ਗਾਰਡਨ ਹੋ ਗਿਆ ਰੋਜ਼ ਗਾਰਡਨ ਹੋ ਗਿਆ ਇਹ ਵੀ ਬਹੁਤ ਪ੍ਰਸਿੱਧ ਜਗ੍ਹਾ ਨੇ ਜਿੱਥੇ ਆਪਾਂ ਘੁੰਮ ਸਕਦੇ ਹਾਂ ਅਤੇ ਆਪਣਾ ਸਟਰੈੱਸ ਨੂੰ ਜਿਹੜਾ ਰਲੀਫ ਕਰ ਸਕਦੇ ਹਾਂ ਇਸੇ ਤਰੀਕੇ ਨਾਲ ਜੇ ਆਪਾਂ ਹੋਰ ਇਲਾਕਿਆਂ ਦੀ ਗੱਲ ਕਰੀਏ ਤਾਂ ਸਾਡਾ ਇੱਥੇ ਧਾਰਮਿਕ ਸਥਾਨ ਹੈਗਾ ਆ ਅੰਮ੍ਰਿਤਸਰ ਸਾਹਿਬ ਜਿੱਥੇ ਅਸੀਂ ਘੁੰਮ ਸਕਦੇ ਹਾਂ ਅਸੀਂ ਦਰਸ਼ਨ ਕਰ ਸਕਦੇ ਹਾਂ ਓਥੇ ਜਾ ਕੇ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਆ ਪੰਜਾਬ ਦੇ ਲੋਕ ਅਕਸਰ ਉੱਥੇ ਜਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਅਤੇ ਉੱਥੋਂ ਦੀ ਦਿਵਾਲੀ ਵੀ ਬਹੁਤ ਵਧੀਆ ਹੁੰਦੀ ਆ